ਸਾਡੇ ਖੇਤਰ ਵਿੱਚ ਬਹੁਤ ਸਾਰੇ ਖੇਡ ਮੈਦਾਨ ਹਨ ਜਿਵੇਂ ਕਿ ਨਹਿਰੂ ਸਟੇਡੀਅਮ ਕੋਲੇਜ ਗਰਾਊਂਡ ਹੋਰ ਵੀ ਬਹੁਤ ਸਾਰੇ ਗਰਾਊਂਡ ਉਪਲਬਧ ਹਨ ਜਿਵੇਂ ਕਿ ਇੱਥੇ ਮੇਨ ਤੌਰ 'ਤੇ ਕ੍ਰਿਕਟ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਹੈ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਨੇ ਇੱਥੇ ਗਰਾਊਂਡ ਵੀ ਬਣਾਇਆ ਹੈ ਅਤੇ ਉਸ ਵਿੱਚ ਕੋਚ ਦਾ ਵੀ ਪ੍ਰਬੰਧ ਕੀਤਾ ਹੈ ਅਤੇ ਇੱਦਾਂ ਹੀ ਵੋਲੀਬੋਲ ਹੈਂਡਬੋਲ ਹੈਂਡਬੋਲ ਦਾ ਮਤਲਬ ਕਿ ਰੋਪੜ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਅਤੇ ਇੱਥੋਂ ਦੇ ਪਲੇਅਰ ਇੰਟਰਨੈਸ਼ਨਲ ਵੀ ਖੇਲ ਕੇ ਆਉਂਦੇ ਹਨ ਅਤੇ ਇੱਦਾਂ ਹੀ ਸਾਰੇ ਗਰਾਊਂਡਸ ਵਿੱਚ ਸਾਰੇ ਕੋਚ ਪੂਰੇ ਹਨ ਅਤੇ ਉਹ ਸਾਰੇ ਬਹੁਤ ਮਿਹਨਤ ਕਰਦੇ ਹਨ